ਸਰ ਮੈਨੂੰ ਇੱਕ ਕੈਬ ਦੀ ਲੋੜ ਹੈ ਮੈਂ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਸੀ ਬਲੋਕ ਮਾਰਕੀਟ 'ਚ ਖੜ੍ਹਾ ਹਾਂ ਇੱਥੇ ਇੱਕ ਰੈਸਟੋਰੈਂਟ ਹੈ ਬੋਨ ਗੈੱਟਯੂ ਨਾਮ ਤੋਂ ਮੈਂ ਉਹਨਾਂ ਦੇ ਸਾਹਮਣੇ ਪਾਰਕਿੰਗ ਏਰੀਆ 'ਚ ਹੀ ਖੜ੍ਹਾ ਅਤੇ ਜਾਣਾ ਮੈਂ ਮੋਲ ਓਫ ਅੰਮ੍ਰਿਤਸਰ ਜੀ ਟੀ ਰੋਡ 'ਤੇ ਹੈ ਅਤੇ ਮੈਨੂੰ ਜ਼ਿਆਦਾ ਵੇਟ ਨਹੀਂ ਕਰਨਾ ਚਾਹੁੰਦਾ ਅਤੇ ਜੇ ਓਟੋ ਵੀ ਮਿਲ ਜਾਵੇ ਜਲਦੀ ਤਾਂ ਉਹ ਵੀ ਚੱਲੇਗਾ